ਮੇਰਾ ਸਭ ਤੋਂ ਵਧੀਆ ਬਾਈਕਿੰਗ ਦਾ ਅਨੁਭਵ ਇਹ ਸੀ ਕਿ ਮੈਂ ਆਪਣੇ ਦੋਸਤ ਨਾਲ ਪਿਛਲੇ ਸਾਲ ਬਾਈਕ ਉੱਤੇ ਲੇਹ ਲਦਾਖ ਗਿਆ ਸੀ ਅਤੇ ਉਸ ਵਿੱਚ ਸਾਨੂੰ ਬਹੁਤ ਆਨੰਦ ਆਇਆ ਸਫਰ ਬਹੁਤ ਵਧੀਆ ਰਿਹਾ ਸੜਕਾਂ ਵੀ ਬਹੁਤ ਵਧੀਆ ਹੋ ਗਈਆਂ ਹਨ ਸਾਨੂੰ ਕੋਈ ਦਿੱਕਤ ਨਹੀਂ ਆਈ ਅਸੀਂ ਲੇਹ ਪਹੁੰਚਣ ਤੱਕ ਸਾਨੂੰ ਤਿੰਨ ਦਿਨ ਦਾ ਸਮਾਂ ਲੱਗਾ ਅਸੀਂ ਉੱਥੇ ਸੋਲੋ ਕੈਂਪਿੰਗ ਵੀ ਕੀਤੀ ਪਰ ਸਾਨੂੰ ਕੋਈ ਦਿੱਕਤ ਨਹੀਂ ਆਈ ਸਾਡੀ ਮੋਟਰਸਾਈਕਲ ਵੀ ਬਹੁਤ ਵਧੀਆ ਚਲਦੀ ਰਹੀ ਸਾਨੂੰ ਕਿਤੇ ਵੀ ਕੋਈ ਦਿੱਕਤ ਨਹੀਂ ਆਈ ਬਾਈਕਿੰਗ ਦਾ ਇੱਕ ਆਪਣਾ ਹੀ ਵੱਖਰਾ ਮਜ਼ਾ ਹੈ ਜੋ ਅਸੀਂ ਕਾਰਾਂ ਵਿੱਚ ਨਹੀਂ ਲੈ ਸਕਦੇ ਬਾਈਕਿੰਗ ਨਾਲ ਅਸੀਂ ਨੇਚਰ ਦੇ ਵਿੱਚ ਚਲਦੇ ਹਾਂ ਕਾਰਾਂ ਵਿੱਚ ਉਹ ਮਜ਼ਾ ਨਹੀਂ ਆਉਂਦਾ ਬਾਈਕਿੰਗ ਇੱਕ ਵੱਖਰਾ ਹੀ ਪੈਸ਼ਨ ਹੈ ਜੋ ਸਾਨੂੰ ਬਹੁਤ ਹੀ ਵਧੀਆ ਫੀਲ ਕਰਵਾਉਂਦਾ ਹੈ ਬਾਈਕਿੰਗ ਦੇ ਨਾਲ ਸਾਨੂੰ ਤੰਦਰੁਸਤੀ ਮਿਲਦੀ ਹੈ ਅਤੇ ਸਾਡੇ ਮਨ ਨੂੰ ਵੀ ਸ਼ਾਂਤੀ ਮਿਲਦੀ ਹੈ ਅਤੇ ਅਸੀਂ ਨੇਚਰ ਦੇ ਵਿੱਚ ਚਲਦੇ ਹਾਂ ਇਹ ਅਨੁਭਵ ਗੱਡੀਆਂ ਵਿੱਚ ਨਹੀਂ ਹੁੰਦਾ ਬਾਈਕਿੰਗ ਬਹੁਤ ਹੀ ਵਧੀਆ ਹੁੰਦੀ ਹੈ ਪਰ ਸਾਨੂੰ ਬਾਈਕਿੰਗ ਵੀ ਬਹੁਤ ਸੰਭਲ ਕੇ ਕਰਨੀ ਚਾਹੀਦੀ ਹੈ ਇਸ ਵਿੱਚ ਰਿਸਕ ਵੀ ਹੁੰਦਾ ਹੈ